ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿਸ਼ੇਸ਼ ਲੋੜਾਂ ਜਾਂ ਅਸਮਰੱਥਾਵਾਂ ਵਾਲੇ ਵਿਦਿਆਰਥੀਆਂ ਨੂੰ ਬਹੁਤ ਚੰਗੀ ਤਰ੍ਹਾਂ ਅਨੂ ਉਦਿਤ ਕਰ ਰਹੀ ਹੈ ਇਹ ਜਿਹੜੇ ਬੱਚੇ ਸਪੈਸ਼ਲ ਹੁੰਦੇ ਨੇ ਸਪੈਸ਼ਲ ਚਾਇਲਡ ਉਹਨਾਂ ਨੂੰ ਅੱਜ ਕੱਲ੍ਹ ਨਾਮ ਦਿੱਤਾ ਗਿਆ ਹੈ ਜਿਹੜੇ ਕਿਸੇ ਵੀ ਤਰੀਕੇ ਦੀ ਉਹਨਾਂ ਦੇ ਸਰੀਰ ਦੇ ਵਿੱਚ ਅਸਮਰੱਥਾ ਮੰਨ ਲਓ ਹੈ ਪਰਮਾਤਮਾ ਵੱਲੋਂ ਕੋਈ ਕਮੀ ਆਈ ਹੈ ਅਤੇ ਉਹਦੇ ਲਈ ਸਿੱਖਿਆ ਪ੍ਰਣਾਲੀ ਬੜੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਉਹਨਾਂ ਲਈ ਬੜੀ ਸੋਹਣੀ ਸਮਲਿਤ ਸਿੱਖਿਆ ਮਤਲਬ ਉਹਨਾਂ ਲਈ ਹੋਸਟਲਸ ਬਣ ਗਏ ਨੇ ਬਹੁਤ ਸਪੋਰਟਸ ਉਹਨਾਂ ਲਈ ਪ੍ਰੋਵਾਈਡ ਕੀਤੇ ਜਾ ਰਹੇ ਨੇ ਅੱਜ ਦੇ ਜ਼ਮਾਨੇ ਦੇ ਵਿੱਚ ਅਤੇ ਜਿਹਦੇ ਕਰਕੇ ਇਹ ਬੱਚੇ ਜਿਹੜੇ ਨੇ ਆਪਣੀ ਬਹੁਤ ਵਧੀਆ ਤਰੀਕੇ ਇਹਨਾਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਅੰਧ ਵਿਦਿ ਵਿਦਿਆਲਿਆ ਹੈ ਜਿਹੜੇ ਬੱਚੇ ਨੇਤਰਹੀਣ ਹਨ ਉੱਥੇ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਰੱਖਿਆ ਜਾਂਦਾ ਹੈ ਬਹੁਤ ਚੰਗੇ ਤਰੀਕੇ ਉਹਨਾਂ ਨੂੰ ਸਿੱਖਿਆ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡੀ ਵਧੀਆ ਉਪਰਾਲਾ ਹੈ ਇਸ ਤੋਂ ਇਲਾਵਾ ਅੱਜ ਦੇ ਜ਼ਮਾਨੇ ਦੇ ਵਿੱਚ ਇਹਨਾਂ ਨੂੰ ਨਾ ਐਕਟੀਵਿਟੀ ਮੈਥਡ ਦੇ ਨਾਲ ਸਿਖਾਇਆ ਜਾਂਦਾ ਇਸ ਤਰ੍ਹਾਂ ਲਰਨਿੰਗ ਬਾਏ ਡੂਇੰਗ ਐਕਟੀਵਿਟੀ ਕਰਦੇ ਕਰਦੇ ਬੱਚੇ ਕਿੰਨਾ ਕੁਝ ਸਿੱਖ ਲੈਂਦੇ ਨੇ ਇਹਨਾਂ ਲਈ ਬਹੁਤ ਸਾਰੇ ਸਪੈਸ਼ਲ ਸਕੂਲ ਬਣੇ ਹੋਏ ਨੇ ਜਿਸ ਕਰਕੇ ਬੱਚੇ ਜਿਹੜੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੀ ਕਮੀ ਆ ਉਹਨੂੰ ਪੂਰਾ ਕਰ ਰਹੇ ਨੇ ਅਤੇ ਕੁਛ ਨਾ ਕੁਛ ਸਿੱਖ ਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਹੋ ਰਹੇ ਨੇ